ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਹਾਂਜੀ ਮੈਡਮ ਜੀ ਜੁੱਤੀਆਂ ਵਾਲੀ ਦੁਕਾਨ ਤੋਂ ਹਾਂਜੀ ਹਾਂਜੀ ਦੱਸੋ ਜੁੱਤੀਆਂ ਸਾਡੇ ਕੋਲ ਹਰ ਤਰ੍ਹਾਂ ਦੀਆਂ ਹਾਂਜੀ ਸਾਡੇ ਕੋਲ ਹੁਣ ਦੇ ਮੌਸਮ ਦੇ ਪਾਣ ਦੇ ਬੰਦ ਜੁੱਤੀਆਂ ਵੀ ਹੈ ਸਾਡੇ ਕੋਲ ਸੈਂਡਲ ਟਾਈਪ ਵੀ ਹੈ ਸਾਡੇ ਕੋਲ ਮੂਹਰਿਓ ਬੰਦ ਪਿੱਛੋਂ ਬੈਕ ਓਪਨ ਵਾਲੀ ਜੁੱਤੀ ਵੀ ਹੈ ਅਤੇ ਤੁਸੀਂ ਜਿੱਦਾਂ ਦੀ ਦੱਸੋ ਕਿੱਦਾਂ ਦੀ ਪਸੰਦ ਕਰਦੇ ਹੋ ਉੱਦਾਂ ਦੀ ਤੁਹਾਨੂੰ ਦੱਸਦੇ ਹਾਂ ਹਾਂਜੀ ਹਾਂਜੀ ਪੰਜਾਬੀ ਜੁੱਤੀ ਵੀ ਹੈ ਬਿਲਕੁਲ ਬਿਲਕੁਲ ਸਾਡੇ ਕੋਲ ਕਢਾਈ ਵਾਲੀ ਜੁੱਤੀ ਵੀ ਹੈਗੀ ਆ ਉਹਦੇ ਵਿੱਚ ਰੰਗ ਵੀ ਅਵੇਲਵਲ ਹਨ ਤੁਸੀਂ ਦੱਸੋ ਤੁਸੀਂ ਕਿਹੜੇ ਰੰਗ ਦੀ ਜੁੱਤੀ ਚਾਹੁੰਦੇ ਉਹ ਫਿਰ ਪੰਜਾਬੀ ਜੁੱਤੀ ਵਿੱਚ ਹੀਲ ਨਹੀਂ ਆਉਣੀ ਅਗਰ ਤੁਸੀਂ ਹੀਲ ਵਾਲੀ ਜੁੱਤੀ 'ਚ ਹਾਂਜੀ ਹਾਂਜੀ ਹਾਂਜੀ ਡੈਫੀਨੇਟ ਗੋਲਡਨ ਕਲਰ ਦੇ ਵਿੱਚ ਹੀਲ ਵਾਲੀ ਜੁੱਤੀ ਹੈ ਉਹਦੇ ਵਿੱਚ ਵੈਜ ਹੀਲ ਵੀ ਮਿਲ ਜਾਵੇਗੀ ਅਤੇ ਸਿੰਪਲ ਹੀਲ ਵੀ ਮਿਲ ਜਾਊਗੀ ਹੀਲ ਡੇਢ ਤੋਂ ਦੋ ਇੰਚ ਦੀ ਵੀ ਹੈ ਅਗਰ ਹਾਈ ਹੀਲ ਲੈਣੀ ਹੈਗੀ ਤਾਂ ਸਾਡੇ ਕੋਲ ਉਹ ਵੀ ਅਵੇਲੇਬਲ ਹੈ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਡੈਫੀਨੇਟ ਹਾਂਜੀ ਅਸੀਂ ਜਿਸ ਤਰ੍ਹਾਂ ਮਨਪ੍ਰੀਤ ਨੂੰ ਦਿੱਤੀ ਹੈ ਜੁੱਤੀ ਵਧੀਆ ਉੱਦਾਂ ਹੀ ਤੁਹਾਨੂੰ ਦੇਵਾਂਗੇ ਅਤੇ ਵਾਜਿਬ ਰੇਟਾਂ 'ਤੇ ਦੇਵਾਂਗੇ ਬਿਲਕੁਲ ਬਿਲਕੁਲ ਇਹ ਸਾਡੇ ਕੋਲ ਲੋਕਲ ਬਰਾਂਡ ਨਹੀਂ ਹੁੰਦਾ ਸਾਡੇ ਕੋਲ ਬ੍ਰੈਂਡ ਅੱਛੇ ਵਾਲਾ ਹੁੰਦਾ ਬ੍ਰੈਂਡਿਡ ਜੁੱਤੀਆਂ ਹੀ ਹੁੰਦੀਆਂ ਔਰ ਉਹਦੇ 'ਤੇ ਵੀ ਅਸੀਂ ਡਿਸਕਾਊਂਟ ਦਿੰਦੇ ਆ ਆਪਣੇ ਗ੍ਰਾਹਕ ਨੂੰ ਅਤੇ ਤੁਹਾਨੂੰ ਵਧੀਆ ਜੁੱਤੀ ਮਜ਼ਬੂਤ ਜੁੱਤੀ ਤੁਹਾਨੂੰ ਸਹੀ ਰੇਟ 'ਤੇ ਸਾਡੇ ਕੋਲੋਂ ਮਿਲੇਗੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਜਦੋਂ ਵੀ ਤੁਸੀਂ ਦੁਕਾਨ 'ਤੇ ਆਏ ਸਾਡੇ ਕੋਲ ਤੁਸੀਂ ਆਓ ਅਸੀਂ ਹਮ ਅਵੇਲੇਬਲ ਨੌ ਤੋਂ ਲੈ ਕੇ ਰਾਤ ਦੇ ਅੱਠ ਵਜੇ ਤੱਕ ਸਾਡਾ ਜਿਹੜੀ ਇਹ ਸ਼ੋਰੂਮ ਹੈ ਖੁੱਲ੍ਹਾ ਹੁੰਦਾ ਆ ਤੁਸੀਂ ਕਦੋਂ ਵੀ ਆ ਕੇ ਸਾਡੇ ਕੋਲ ਜੁੱਤੀਆਂ ਲੈ ਸਕਦੇ ਨਾਲੇ ਹੁਣ ਤਾਂ ਹੋਰ ਵੀ ਜ਼ਿਆਦਾ ਡਿਸਕਾਊਂਟ ਚੱਲ ਰਿਹਾ ਅਤੇ ਉਹਦੇ ਵਿੱਚ ਸਾਨੂੰ ਅਸੀਂ ਪੰਜ ਤੋਂ ਲੈ ਕੇ ਦਸ ਪ੍ਰਸੈਂਟ ਤੱਕ ਆਪਣੇ ਗਾਹਕ ਨੂੰ ਡਿਸਕਾਊਂਟ ਦਿੰਦੇ ਹਾਂ ਓਕੇ ਧੰਨਵਾਦ ਸਤਿ ਸ਼੍ਰੀ ਅਕਾਲ